ਸਾਡੇ ਸਮਾਜ ਵਿੱਚ ਸਭ ਤੋਂ ਵੱਡੀ ਬੁਰਾਈ ਹੈ ਭਰੂਣ ਹੱਤਿਆ ਯਾਨੀ ਕਿ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣਾ ਇਹ ਇੱਕ ਬਹੁਤ ਵੱਡਾ ਕਲੰਕ ਹੈ ਸਮਾਜ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਅਜੋਕੇ ਸਮੇਂ ਵਿੱਚ ਧੀ ਵੀ ਪੁੱਤਾਂ ਨਾਲੋਂ ਘੱਟ ਨਹੀਂ ਹੈ ਉਹ ਹਰ ਖੇਤਰ ਦੇ ਵਿੱਚ ਵੱਧ ਚੜ ਕੇ ਮੁੰਡਿਆਂ ਨਾਲੋਂ ਵੱਧ ਕਮਾਈ ਕਰਕੇ ਸਮਾਜ ਦੇ ਵਿੱਚ ਵਧੀਆ ਆਪਣਾ ਯੋਗਦਾਨ ਪਾ ਰਹੀ ਹੈ ਕਿਉਂਕਿ ਇੱਕ ਧੀ ਧੀ ਪੜਨ ਨਾਲ ਦੋ ਪਰਿਵਾਰ ਪੜ ਜਾਂਦੇ ਹਨ ਜੇਕਰ ਆਪਾਂ ਇੱਕ ਧੀ ਨੂੰ ਵਧੀਆ ਪਾਲਣ ਪੋਸ਼ਣ ਕਰਕੇ ਚੰਗੀ ਸਿੱਖਿਆ ਕਹਿੰਦੇ ਹਾਂ ਤਾਂ ਇਕ ਉਹ ਦੂਸਰੇ ਘਰ ਵਿੱਚ ਜਾ ਕੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਦੀ ਵਧੀਆ ਪਰਵਰਿਸ਼ ਕਰਕੇ ਇਕ ਪੜੇ ਲਿਖੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ ਇਸ ਕਰਕੇ ਕਦੇ ਵੀ ਲੜਕੀ ਨੂੰ ਪਰਿਵਾਰ ਜਾਂ ਸਮਾਜ ਤੇ ਬੋਝ ਨਹੀਂ ਸਮਝਣਾ ਚਾਹੀਦਾ ਸਗੋਂ ਉਸ ਨੂੰ ਵੱਧ ਪੜਾ ਲਿਖਾ ਕੇ ਇੱਕ ਚੰਗੇ ਸਮਾਜ ਵਿੱਚ ਉਸਦਾ ਰੁਤਬਾ ਕਾਇਮ ਕਰਨਾ ਚਾਹੀਦਾ ਹੈ ਇਕ ਧੀ ਨੂੰ ਹਮੇਸ਼ਾ ਹੀ ਪ੍ਰਮੋਟ ਕਰੋ ਕਿ ਉਹ ਅੱਗੇ ਵਧੇ ਅਤੇ ਇੱਕ ਚੰਗਾ ਸਮਾਜ ਪ੍ਰਫੁਲਿਤ ਹੋਵੇ ਅਜੋਕੇ ਖੇਤਰ ਵਿੱਚ ਜਿੱਥੇ ਮੁੰਡੇ ਤਰੱਕੀਆਂ ਕਰ ਰਹੇ ਹਨ ਉਥੇ ਕੁੜੀਆਂ ਵੀ ਪੁਲਿਸ ਅਫਸਰ ਪਾਇਲਟ ਡਾਕਟਰ ਹਰ ਵਰਗ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੀਆਂ ਹਨ ਅਤੇ ਵੱਡੇ ਵੱਡੇ ਅਹੁਦਿਆਂ ਤੇ ਅਫਸਰ ਬਣ ਕੇ ਇਹ ਸਮਾਜ ਨੂੰ ਚੰਗੀ ਸੇਧ ਦੇ ਰਹੀਆਂ ਹਨ ਇਸ ਕਰਕੇ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਬੱਚੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿਓ ਕਿਉਂਕਿ ਅੱਜ ਦੀਆਂ ਧੀਆਂ ਸਮਾਜ ਤੇ ਬੋਝ ਨਹੀਂ ਹਨ ਸਗੋਂ ਸਮਾਜ ਦਾ ਦੇਸ਼ ਦਾ ਮਾਣ ਹਰ ਖੇਤਰ ਵਿੱਚ ਵਧਾਉਂਦੀਆਂ ਹਨ ਖੇਡਾਂ ਵਿੱਚ ਅਤੇ ਪੜ੍ਹਾਈ ਵਿੱਚ ਕੁੜੀਆਂ ਬਹੁਤ ਮੱਲਾਂ ਮਾਰ ਰਹੀਆਂ ਹਨ ਮੁੰਡਿਆਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ ਇੱਕ ਧੀ ਦੇ ਪੜਨ ਨਾਲ ਪੂਰਾ ਸਮਾਜ ਪੜ ਜਾਂਦਾ ਹੈ ਇੱਕ ਪੜੀ ਹੋਈ ਧੀ ਪੂਰੇ ਸਮਾਜ ਨੂੰ ਸੇਧ ਦਿੰਦੀ ਹੈ ਜਿੱਥੇ ਉਹ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਦੀ ਹੈ ਉੱਥੇ ਸਮਾਜ ਨੂੰ ਵੀ ਚੰਗੀ ਸੇਧ ਦਿੰਦੀ ਹੈ ਕਦੇ ਵੀ ਧੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਅਤੇ ਇਸ ਨਾ ਮੁਰਾਦ ਬਿਮਾਰੀ ਨੂੰ ਹਮੇਸ਼ਾ ਲਈ ਸਮਾਜ ਵਿੱਚੋਂ ਖਤਮ ਕਰਨਾ ਚਾਹੀਦਾ ਹੈ ਅਤੇ ਭਰੂਣ ਹੱਤਿਆ ਨੂੰ ਰੋਕਣਾ ਚਾਹੀਦਾ ਹੈ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਵੱਲ ਧਿਆਨ ਦੇਣਾ ਚਾਹੀਦਾ ਹੈ